ਜੇ ਮੈਂ ਆਪਣੇ ਸ਼ੌਂਕ ਦੀ ਗੱਲ ਕਰਾਂ ਤਾਂ ਮੈਨੂੰ ਦੌੜਨ ਦਾ ਸ਼ੌਂਕ ਪਿਛਲੇ ਚਾਰ ਤੋਂ ਪੰਜ ਸਾਲਾਂ ਤੋਂ ਹੀ ਹੋਇਆ ਹੈ ਜੇ ਮੈਂ ਉਸ ਤੋਂ ਪਹਿਲਾਂ ਦੀ ਗੱਲ ਕਰਾਂ ਤਾਂ ਮੈਂ ਬਹੁਤ ਜ਼ਿਆਦਾ ਮੋਟਾ ਸੀ ਅਤੇ ਮੈਂ ਬਹੁਤ ਓਵਰਵੇਟ ਸੀ ਜਿਸ ਨਾਲ ਮੈਨੂੰ ਕਾਫ਼ੀ ਪਰੇਸ਼ਾਨੀਆਂ ਆ ਰਹੀਆਂ ਸੀ ਫਿਰ ਇੱਕ ਦਿਨ ਮੈਨੂੰ ਕਿਸੇ ਨੇ ਪ੍ਰੇਰਿਤ ਕੀਤਾ ਕਿ ਆਪਣਾ ਵੇਟ ਲੂਜ਼ ਕਰੋ ਘੱਟ ਕਰੋ ਤਾਂ ਉਸ ਦਿਨ ਤੋਂ ਫਿਰ ਮੈਂ ਐਕਸਰਸਾਈਜ਼ ਸ਼ੁਰੂ ਕੀਤੀ ਐਕਸਰਸਾਈਜ਼ ਅੱਜ ਮੈਨੂੰ ਐਕਸਰਸਾਈਜ਼ ਕਰਦੇ ਹੋਏ ਚਾਰ ਤੋਂ ਪੰਜ ਸਾਲ ਹੋ ਗਏ ਹਨ ਜਿਸ ਨਾਲ ਮੈਂ ਅਠਾਰਾਂ ਤੋਂ ਉੱਨੀ ਕਿੱਲੋ ਵੇਟ ਲੂਜ਼ ਕੀਤਾ ਹੈ ਅਤੇ ਉਸ ਤੋਂ ਬਾਅਦ ਮੈਂ ਆਪਣੇ ਜੀਵਨ 'ਚ ਬਹੁਤ ਚੇਂਜ ਦੇਖ ਰਿਹਾ ਹਾਂ ਜੇ ਮੈਂ ਚੇਂਜਿਸ ਦੀ ਗੱਲ ਕਰਾਂ ਤਾਂ ਮੈਂ ਫਿਜ਼ੀਕਲੀ ਬਹੁਤ ਫਿੱਟ ਹੋ ਗਿਆ ਹਾਂ ਮੈਨੂੰ ਸਟ੍ਰੈੱਸ ਬਹੁਤ ਘੱਟ ਹੁੰਦਾ ਹੈ ਅਤੇ ਮੇਰਾ ਸਟੈਮੀਨਾ ਵੀ ਵੱਧ ਗਿਆ ਹੈ ਇਸ ਤੋਂ ਇਲਾਵਾ ਮੈਂ ਪਹਿਲਾਂ ਮੋਟਾ ਸੀ ਤਾਂ ਮੇਰੇ 'ਤੇ ਕੱਪੜੇ ਸੂਟ ਨਹੀਂ ਸੀ ਕਰਦੇ ਬੱਟ ਹੁਣ ਮੈਨੂੰ ਮੇਰੇ ਸਾਈਜ਼ ਦੇ ਕੱਪੜੇ ਵੀ ਇਜ਼ੀਲੀ ਮਿਲ ਜਾਂਦੇ ਹਨ ਮੈਂ ਰਿਕਮੈਂਡ ਕਰਦਾ ਹਾਂ ਕਿ ਸਭ ਨੂੰ ਰਨਿੰਗ ਜਾਂ ਕੋਈ ਵੀ ਫਿਜ਼ੀਕਲ ਐਕਸਰਸਾਈਜ਼ ਕਰਨੀ ਚਾਹੀਦੀ ਹੈ ਜਿਸ ਨਾਲ ਮੈਂਟਲੀ ਅਤੇ ਫਿਜ਼ੀਕਲੀ ਫਿੱਟ ਰਿਹਾ ਸਕੇ